ਕਠੋਰ ਗਰਮੀਆਂ ਅਤੇ ਸਰਦੀਆਂ ਵਿੱਚ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਖਾਣ ਵਾਲਾ ਚਾਰਾ ਜੋ ਬਰਸੀਨ ਹੁੰਦੀ ਹੈ ਉਹ ਠੰਡ ਅਤੇ ਕੋਰੇ ਦੇ ਕਾਰਨ ਮਰ ਜਾਂਦੀ ਹੈ ਉਸ ਨੂੰ ਵਸਾਉ ਬਚਾਉਣ ਵਾਸਤੇ ਇੱਕ ਤਰ੍ਹਾਂ ਦੀ ਸਪਰੇਅ ਆਉਂਦੀ ਹੈ ਜਾਂ ਕੁਦਰਤੀ ਤੌਰ 'ਤੇ ਉਹ ਦੂਜੇ ਪਾਸੇ ਹੈ ਆਲੂ ਆਲੂਆਂ ਦਾ ਜੋ ਸਰਦੀਆਂ ਦੇ ਵਿੱਚ ਹਨ ਆਲੂ ਕੋਰੇ ਕਾਰਨ ਬਿਲਕੁਲ ਮਰ ਜਾਂਦੇ ਹਨ ਅਤੇ ਤੀਜੇ ਨੰਬਰ 'ਤੇ ਜੋ ਫੁੱਲ ਅਤੇ ਬੂਟੇ ਹਨ ਉਹ ਗਰਮੀਆਂ ਦੇ ਵਿੱਚ ਜ਼ਿਆਦਾਤਰ ਮਰ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਜਾਂ ਤਾਂ ਉਹਨਾਂ ਨੂੰ ਪਾਣੀ ਜ਼ਿਆਦਾ ਦੇ ਕੇ ਬਚਾਇਆ ਜਾ ਸਕਦਾ ਹੈ ਜਾਂ ਫਿਰ ਉਸ ਨੂੰ ਮੋਮੀ ਕਾਗਜ਼ ਦਾ ਇੱਕ ਕਬਰ ਚੜ੍ਹਾ ਕੇ ਉੱਪਰ ਜਿਸ ਤਰ੍ਹਾਂ ਮਹ ਪਿੰਡਾਂ ਦੇ ਵਿੱਚ ਕੀਤਾ ਜਾਂਦਾ ਹੈ ਉਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਅਤੇ ਗਰਮੀਆਂ ਅਤੇ ਸਰਦੀਆਂ ਦੇ ਬੂਟਿਆਂ ਵਿੱਚ ਇਹ ਅੰਤਰ ਹੈ ਅਤੇ ਜ਼ਿਆਦਾਤਰ ਇਹੀ ਹੈ